ਮੈਂ ਐਮਾਜ਼ੋਨ 'ਤੇ ਪੇਟਿੰਗ ਬੁੱਕ ਮੰਗਵਾਈ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗੀ ਮੈਂ ਸੋਚਦਾ ਸੀ ਕਿ ਉਸ ਦੇ ਨਾਲ ਦੇ ਕਈ ਹੋਰ ਅਲੱਗ ਅਲੱਗ ਅਕਾਰ ਦੀਆਂ ਹੋਰ ਅਲੱਗ ਅਲੱਗ ਬੁੱਕਾਂ ਮੰਗਾਵਾ ਜੋ ਕਿ ਮੇਰੇ ਲਈ ਹੋਰ ਵੀ ਵਧੀਆ ਸਾਬਤ ਹੋਣ